ਹੈਲੋ ਗੁੱਡ ਈਵਨਿੰਗ ਸਰ ਸਰ ਹਾਂਜੀ ਮੈਂ ਨਾ ਤੁਹਾਨੂੰ ਦੱਸਣਾ ਸੀਗਾ ਕਿ ਮੈਂ ਕੱਲ੍ਹ ਐਕਚੁਅਲੀ ਤੁਹਾਡੀ ਨਾ ਟਰਾਂਸਪੋਰਟ ਏਜੰਸੀ ਤੋਂ ਨਾ ਇੱਕ ਕੈਬ ਬੁੱਕ ਕੀਤੀ ਸੀਗੀ ਆਪਣੇ ਲਈ ਐਕਚੁਲੀ ਮੈਨੂੰ ਟਰੈਵਲ ਕਰਨਾ ਸੀਗਾ ਰੋਪੜ ਤੋਂ ਡੈਲੀ ਲਈ ਹੈ ਨਾ ਅਤੇ ਉਸ ਟਾਈਮ ਮੈਨੂੰ ਬਾਰਿਸ਼ ਦੀ ਵਜ੍ਹਾ ਨਾਲ ਮੈਨੂੰ ਕੁਛ ਮਿਲ ਨਹੀਂ ਰਿਹਾ ਸੀਗਾ ਟਰਾਂਸਪੋਰਟ ਤਾਂ ਮੈਂ ਉਸ ਕਰਕੇ ਕੈਬ ਬੁੱਕ ਕੀਤੀ ਸੀਗੀ ਅਤੇ ਕੈਬ ਤਾਂ ਚਲੋ ਟਾਈਮਲੀ ਮੇਰੇ ਪਾਸ ਪਹੁੰਚ ਗਈ ਸੀਗੀ ਸਵੇਰੇ ਜਿੱਦਾਂ ਹੀ ਟਾਈਮ ਦਿੱਤਾ ਸੀਗਾ ਉਨ੍ਹਾਂ ਨੂੰ ਕਿ ਚਾਰ ਜਾਂ ਸਾਢੇ ਚਾਰ ਵਜੇ ਤੱਕ ਪਹੁੰਚ ਜਾਣ ਕਿਉਂਕਿ ਮੈਨੂੰ ਪੰਜ ਵਜੇ ਮੈਂ ਉੱਥੋਂ ਟਰੈਵਲ ਸਟਾਰਟ ਕਰਨਾ ਸੀਗਾ ਆਪਣੀ ਜਰਨੀ ਅਤੇ ਹੁਣ ਨਾ ਮੈਂ ਸਰ ਫਾਇਨਲੀ ਆਪਣੇ ਮਤਲਬ ਡੈਸਟੀਨੇਸ਼ਨ 'ਤੇ ਤਾਂ ਪਹੁੰਚ ਗਈ ਹੈ ਪਰ ਮੈਂ ਇੱਕ ਚੀਜ਼ ਨੂੰ ਲੈ ਕੇ ਨਾ ਕੰਨਫਿਊਜ਼ ਹੈ ਕਿ ਜਿਵੇਂ ਮੈਂ ਆਪਣੀ ਜਿਹੜੀ ਪੈਮੇਂਟ ਹੈ ਉਹ ਕਿਵੇਂ ਕਰਾਂ ਮੈਂ ਆਪਣੀ ਜਿਹੜੀ ਨਕਦੀ ਕਰ ਸਕਦੀ ਉਸ ਚੀਜ਼ ਲਈ ਜਾਂ ਫਿਰ ਮੈਨੂੰ ਕੋਈ ਹੋਰ ਮੋਡ ਅਪਲਾਈ ਕਰਨਾ ਪੈਣਾ ਕਿਉਂਕਿ ਮੈਂ ਹੁਣ ਤੁਹਾਡੇ ਡਰਾਇਵਰ ਨਾਲ ਗੱਲ ਕੀਤੀ ਸੀਗੀ ਜਿਨ੍ਹਾਂ ਨੂੰ ਤੁਸੀਂ ਕੈਬ ਦੇ ਵਿੱਚ ਭੇਜਿਆ ਸੀਗਾ ਮੇਰੇ ਲਈ ਅਤੇ ਹੁਣ ਉਨ੍ਹਾਂ ਨੂੰ ਵੀ ਸ਼ਾਇਦ ਕੁਛ ਆਈਡੀਆ ਨਹੀਂ ਹੋਣਾ ਕੁਛ ਕੰਫਰਮ ਨਹੀਂ ਹੈ ਕਿ ਇਹ ਚੀਜ਼ ਨਕਦੀ ਹੋ ਸਕਦੀ ਹੈ ਜਾਂ ਔਨਲਾਈਨ ਹੋ ਸਕਦੀ ਹੈ ਅਤੇ ਉਸ ਕਰਕੇ ਫਿਰ ਮੈਂ ਵੀ ਉਨ੍ਹਾਂ ਤੋਂ ਜ਼ਿਆਦਾ ਕਲੀਅਰ ਨਹੀਂ ਕੀਤਾ ਫਿਰ ਮੈਂ ਡਾਇਰੈਕਟ ਹੀ ਤੁਹਾਨੂੰ ਕੋਲ ਲਗਾ ਲਈ ਹੈ ਅਤੇ ਹੁਣ ਮੇਰੀ ਥੋੜ੍ਹੀ ਜਿਹੀ ਇਹ ਕੰਨਫਿਊਜ਼ਨ ਨੂੰ ਦੂਰ ਕਰ ਦੋ ਕਿ ਮੈਂ ਹੁਣ ਜਾਂ ਇਹਨੂੰ ਕੈਸ਼ ਦੇਵਾਂ ਜਾਂ ਫਿਰ ਮੈਂ ਇਨ੍ਹਾਂ ਨੂੰ ਤੁਹਾਨੂੰ ਔਨਲਾਈਨ ਪੇਮੈਂਟ ਕਰਾਂ ਔਰ ਕਿਸ ਤਰ੍ਹਾਂ ਨਾਲ ਕਰਾਂ ਹਾਂਜੀ ਅਤੇ ਮੈਨੂੰ ਹੁਣ ਸਰ ਮੇਰੇ ਪਾਸ ਤਾਂ ਗੂਗਲ ਪੇਅ ਪੇਟੀਐੱਮ ਦੋਨੋਂ ਚੱਲਦੇ ਹੈ ਦੋਨੋਂ ਵਰਕਿੰਗ ਹੈ ਤੁਸੀਂ ਮੈਨੂੰ ਦੱਸ ਦੋ ਕਿਸ ਅਕੋਰਡਿੰਗ ਇਹ ਹੋਣਾ ਚਾਹੀਦਾ ਹੈ ਹਾਂਜੀ ਹਾਂਜੀ ਪੇਟੀਐੱਮ ਮੈਂ ਕਰ ਦਿੰਦੀ ਹੈ ਅਤੇ ਸਰ ਕਿਆ ਮੈਂ ਤੁਹਾਨੂੰ ਡਾਇਰੈਕਟਲੀ ਤੁਹਾਡੇ ਨੰਬਰ 'ਤੇ ਹੀ ਕਰ ਸਕਦੀ ਹਾਂ ਸੋ ਦੈਟ ਕਿ ਤੁਸੀਂ ਉਨ੍ਹਾਂ ਨੂੰ ਸਕਰੀਨਸ਼ੌਟ ਲੈ ਕੇ ਤੁਸੀਂ ਆਪਣੇ ਡਾਇਰੈਕਟ ਡਰਾਇਵਰ ਨੂੰ ਨਾ ਵਟਸਐਪ ਕਰ ਦੋ ਜਾਂ ਕੁਛ ਵੀ ਕਰ ਦੋ ਹੈ ਨਾ ਉਨ੍ਹਾਂ ਨੂੰ ਵੀ ਪਤਾ ਹੋ ਜਾਵੇ ਅਤੇ ਕੰਫਰਮ ਹੋ ਜਾਵੇ ਕਿ ਮੈਂ ਪੇਮੈਂਟ ਕਰ ਦਿੱਤੀ ਹੈ ਹਾਂਜੀ ਹਾਂਜੀ ਸਰ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸੋ ਮੱਚ